ਦਿਹਾਤੀ ਖੇਤਰ ਦੀ ਜੀ ਮੁੱਖ ਟੈਕਨੋਲੋਜੀ ਦੀਆਂ ਸਭ ਤੋਂ ਵੱਡੀ ਚੁਣੌਤੀ ਤਾਂ ਜੀ ਜਿਹੜਾ ਹੈਗਾ ਨੈੱਟਵਰਕ ਏ ਹੈ ਨੈੱਟਵਰਕ ਦੀ ਜਿਹੜੀ ਹਜੇ ਵੀ ਪਿੰਡਾਂ ਦੇ ਵਿੱਚ ਬੜੀ ਸਮੱਸਿਆ ਅਤੇ ਇਹਦੇ ਨਾਲ ਬੜੀ ਥਾਵਾਂ ਇਹੋ ਜਿਹੇ ਵਿਚਾਲਲੇ ਪਿੰਡ ਇਹੋ ਜਿਹੇ ਨੇ ਜਿੱਥੇ ਹਜੇ ਵੀ ਜਿਹੜੀ ਰੇਂਜ ਪੂਰੀ ਨਹੀਂ ਆਉਂਦੀ ਹੈਗੀ ਅਤੇ ਇਹਨਾਂ ਦਾ ਹੱਲ ਕਰਨ ਦੀ ਸਾਨੂੰ ਲੋੜ ਹੈ